ਅਸੀਂ ਅਕਸਰ ਦੇਖਦੇ ਹਾਂ ਕਿ ਸਰਕਾਰੀ ਬੈਂਕਾਂ ਵਿੱਚ ਲੋਕਾਂ ਨੂੰ ਕਈ ਕਈ ਘੰਟੇ ਖੜੇ ਹੋਣਾ ਪੈਂਦਾ ਹੈ ਮੈਂ ਤਾਂ ਇਹ ਹੀ ਚਾਹੁੰਦੀ ਹਾਂ ਕਿ ਜਿਹੜੇ ਵੀ ਲੋਕ ਕੈਸ਼ ਕਾਊਂਟਰ 'ਤੇ ਆਉਂਦੇ ਹਨ ਉਹਨਾਂ ਨੂੰ ਘੰਟਾ ਘੰਟਾ ਖੜੇ ਹੋਣਾ ਪੈਂਦਾ ਹੈ ਇਸ ਲਈ ਜੋ ਬਦਲਾਵ ਮੈਂ ਚਾਹੁੰਦੀ ਹਾਂ ਕਿ ਉਹਨਾਂ ਨੂੰ ਜ਼ਿਆਦਾ ਦੇਰ ਤੱਕ ਖੜੇ ਨਾ ਹੋਣਾ ਪਵੇ ਕੈਸ਼ ਕਾਊਂਟਰ 'ਤੇ ਜਿੱਥੇ ਇੱਕ ਬੰਦਾ ਹੈ ਉੱਥੇ ਦੋ ਬੰਦੇ ਲੱਗ ਸਕਦੇ ਹਨ ਦੋ ਬੰਦੇ ਜਦ ਲੱਗਣਗੇ ਤਾਂ ਉੰਨਾ ਹੀ ਲੋਕਾਂ ਦਾ ਟਾਈਮ ਘਟੇਗਾ ਮੈਂ ਅਕਸਰ ਫੀਡਬੈਕ ਪ੍ਰਦਾਨ ਕੀਤਾ ਹੈ ਉਹਨਾਂ ਦਾ ਜਵਾਬ ਇਹ ਹੀ ਆਉਂਦਾ ਹੈ ਕਿ ਤੁਹਾਨੂੰ ਅਗਲੀ ਵਾਰ ਤੋਂ ਕੋਈ ਦਿੱਕਤ ਪ੍ਰਦਾਨ ਨਹੀਂ ਹੋਵੇਗੀ ਪਰ ਜਿਸ ਤੱਕ ਜਿੱਥੇ ਤੱਕ ਮੈਂ ਦੇਖਿਆ ਹੈ ਉਸ ਦਾ ਕੋਈ ਵੀ ਨਤੀਜਾ ਨਹੀਂ ਨਿਕਲ ਕੇ ਆਉਂਦਾ ਇਸ ਲੀਏ ਮੈਨੂੰ ਲੱਗਦਾ ਹੈ ਕਿ ਜੇ ਕਰ ਫੀਡਬੈਕ ਲੈਣਾ ਹੈ ਤਾਂ ਉਸਨੂੰ ਚੰਗੇ ਤਰੀਕੇ ਨਾਲ ਫੁਲਫਿਲ ਵੀ ਕੀਤਾ ਜਾਣਾ ਚਾਹੀਦਾ ਹੈ ਅਸੀਂ ਅਕਸਰ ਦੇਖਦੇ ਹਾਂ ਕਿ ਕਿਸੇ ਬੰਦੇ ਨੇ ਐਫ ਡੀ ਕਰਵਾਈ ਹੁੰਦੀ ਹੈ ਲੇਕਿਨ ਪੰਜ ਸਾਲਾਂ ਬਾਅਦ ਉਸ ਦਾ ਕੁਛ ਫ਼ਾਇਦਾ ਨਹੀਂ ਹੁੰਦਾ ਉਹ ਐਫ ਡੀ ਉਹਨਾਂ ਦੇ ਅਕਾਊਂਟਾਂ ਵਿੱਚ ਸ਼ੋ ਹੀ ਨਹੀਂ ਕਰਦੀ ਹੈ ਬਥੇਰੇ ਪ੍ਰਾਈਵੇਟ ਬੈਂਕਾਂ ਨੇ ਕੀਤਾ ਹੈ ਪਰ ਜੇਕਰ ਕਿਸੇ ਸਰਕਾਰੀ ਬੈਂਕ ਦੀ ਗੱਲ ਕਰੀਏ ਤਾਂ ਉੱਥੇ ਆ ਹੀ ਦਿੱਕਤ ਹੈ ਕਿ ਉਹ ਆਪਣੇ ਗ੍ਰਾਹਕਾਂ ਨੂੰ ਚੰਗੀ ਤਰ੍ਹਾਂ ਡੀਲ ਨਹੀਂ ਕਰਦੇ ਉਹਨਾਂ ਨੂੰ ਘੰਟਾ ਘੰਟਾ ਇੰਤਜ਼ਾਰ ਕਰਨਾ ਪੈਂਦਾ ਹੈ ਕਿ ਕਦ ਕੋਈ ਉਹਨਾਂ ਕੋਲ ਆਵੇਗਾ ਅਤੇ ਉਹਨਾਂ ਦੀ ਗੱਲ ਨੂੰ ਸੁਣਿਆ ਜਾਵੇਗਾ ਘੰਟਾ ਘੰਟਾ ਉਹ ਪੈਸਿਆਂ ਦੀ ਲਾਈਨ 'ਚ ਖੜੇ ਰਹਿੰਦੇ ਹਨ ਚਾਹੇ ਪੈਸੇ ਨਿਕਲਵਾਉਣੇ ਹੋਣ ਚਾਹੇ ਜਮ੍ਹਾਂ ਕਰਵਾਉਣੇ ਹੋਣ ਉਹਨਾਂ ਨੂੰ ਕੋਈ ਵੀ ਚੰਗੀ ਤਰ੍ਹਾਂ ਨਹੀਂ ਪੁੱਛਦਾ ਇਸ ਲਈ ਆਹ ਚਾਹੁੰਦੇ ਹਾਂ ਕਿ ਜੇ ਕੋਈ ਬਹਿਤਰੀ ਕਰ ਸਕਦਾ ਹੈ ਤਾਂ ਇਹ ਹੀ ਹੈ ਕਿ ਉਹ ਉਹਨਾਂ ਨੂੰ ਲੋਕਾਂ ਨੂੰ ਬਜ਼ੁਰਗਾਂ ਨੂੰ ਖ਼ਾਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਟਾਈਮ ਖੜੇ ਨਾ ਹੋਣਾ ਪਵੇ ਤਾਂ ਕਿ ਉਹਨਾਂ ਦੇ ਕੰਮ ਜਲਦੀ ਤੋਂ ਜਲਦੀ ਹੋ ਸਕੇ